ਛੱਬੀ ਅਪ੍ਰੈਲ ਦੋ ਹਜ਼ਾਰ ਪੰਜ ਸਤਾਈ ਜੂਨ ਦੋ ਹਜ਼ਾਰ ਤਿੰਨ ਇਕੱਤੀ ਦਸੰਬਰ ਉੱਨੀ ਸੌ ਸੱਤਰ ਉੱਨੀ ਦਸੰਬਰ ਦੋ ਦੋ ਹਜ਼ਾਰ ਉੱਨੀ ਇੱਕ ਜਨਵਰੀ ਦੋ ਹਜ਼ਾਰ ਵੀਹ